ਹਾਂ ਰਵੀਨਾ ਬੋਲ ਰਹੀ ਆ ਹਾਂ ਹੋਰ ਕਿਵੇਂ ਹੈ ਰਵੀਨਾ ਹਾਂ ਮੈਂ ਵੀ ਵਧੀਆ ਹੋਰ ਕਿਵੇਂ ਚੱਲਦਾ ਖੇਤੀਬਾੜੀ ਹਾਂ ਬੱਸ ਚੱਲਦਾ ਪਿਆ ਹੈ ਅੱਛਾ ਹਾਂ ਆਏ ਤਾਂ ਸੀ ਪਤਾ ਨਹੀਂ ਕੀ ਲੈਕਚਰ ਜਿਹਾ ਦੇ ਕੇ ਚਲੇ ਗਏ ਕੀ ਕਹਿੰਦੇ ਸੀ ਉਹ ਵੈਸੇ ਨਹੀਂ ਸੁਣਿਆ ਹੀ ਨਹੀਂ ਅਸੀਂ ਤਾਂ ਸਮਝ ਹੀ ਨਹੀਂ ਆਈ ਹਾਂ ਇਹ ਤਾਂ ਸਹੀ ਕਹਿੰਦੇ ਸੀ ਸੁਣਨਾ ਚਾਹੀਦਾ ਸੀ ਨਹੀਂ ਪਰ ਸਮਝ ਹੀ ਨਹੀਂ ਆਇਆ ਨਾ

ਮੈਂ ਤਾਂ ਨੁਕਸਾਨ ਹੀ ਹੁਣ ਝੋਨੇ 'ਚ ਤਾਂ ਫਾਇਦਾ ਹੁੰਦਾ ਝੋਨਾ ਹੀ ਘੱਟ ਲਾਈ ਜਾਵੇ ਹਮ ਹਾਂ ਉਹ ਤਾਂ ਗੱਲ ਸਹੀ ਹੈ ਮੈਂ ਸੁਣਿਆ ਸੀ ਕਿ ਪੰਜਾਬ ਦਾ ਪਾਣੀ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹਦਾ ਸਤਰ ਘੱਟਦਾ ਜਾ ਰਿਹਾ ਹੈ

ਹਮ ਸਹੀ ਹੈ ਫਿਰ ਤਾਂ ਫਿਰ ਤਾਂ ਸਾਡਾ ਪੰਜਾਬ ਹਰਾ ਭਰਿਆ ਹੋ ਜਾਏਗਾ ਨਾ ਹਾਂ ਉਹ ਤਾਂ ਹੈ ਹੀ ਅੱਜ ਕਲ੍ਹ ਬੰਦੇ ਆਪਣਾ ਹੀ ਸਵਾਰਥ ਵੇਖ ਰਹੇ ਆ ਕੁਦਰਤ ਨੂੰ ਤਾਂ ਪੁੱਛਦੇ ਹੀ ਨਹੀਂ ਕੁਛ

ਹਾਂ ਸਹੀ ਕਹਿੰਦੇ ਸੀ ਫਿਰ ਤਾਂ ਅਤੇ ਜ਼ਰੂਰ ਜ਼ਰੂਰ ਆਪਾਂ ਸਾਰੇ ਮਿਲ ਕੇ ਪਾਵਾਂਗੇ

ਓਕੇ ਠੀਕ ਹੈ